ਭੰਗੜਾ ਇੱਕ ਡਾਂਸ ਵੀ ਹੈ ਇੱਕ ਐਕਸਰਸਾਈਜ਼ ਵੀ ਆ ਜੇ ਨਾਲ ਉਹਦੇ ਮਿਊਜ਼ਿਕ ਹੋ ਜੇ ਸੰਗੀਤ ਹੋ ਜੇ ਤਾਂ ਰਿਧਮ ਦੇ ਨਾਲ ਐਕਸਰਸਾਈਜ਼ ਕਰਨੀ ਕਸਰਤ ਕਰਨੀ ਸੌਖੀ ਰਹਿੰਦੀ ਆ ਇਸ ਕਰਕੇ ਸਾਰੇ ਹੀ ਜਿਮ ਦੇ ਵਿੱਚ ਜਾਂ ਕ ਜਿੱਥੇ ਵੀ ਕੋਈ ਐਕਸਰਸਾਈਜ ਕਰਵਾਈ ਜਾਂਦੀ ਆ ਕੋਈ ਕਸਰਤ ਕਰਵਾਈ ਜਾਂਦੀ ਉੱਥੇ ਮਿਊਜਿਕ ਦੀ ਵਰਤੋਂ ਕੀਤੀ ਜਾਂਦੀ ਆ ਸੰਗੀਤ ਦੀ ਵਰਤੋਂ ਕੀਤੀ ਜਾਂਦੀ ਆ